ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਿਆਦਾ ਛੋਟੇ ਕਾਰੋਬਾਰ ਵੀ ਹਨ ਪਰ ਉਹ ਦੇਸ਼ ਦੀ ਤਰੱਕੀ ਵਿੱਚ ਬੜਾ ਵੱਡਾ ਯੋਗਦਾਨ ਦਿੰਦੇ ਹਨ ਛੋਟੇ ਕਾਰੋਬਾਰ ਕਾਫੀ ਹਨ ਜਿੱਦਾਂ ਮੋਚੀ ਦਾ ਕੰਮ ਕਾਰਪੈਂਟਰ ਦਾ ਕੰਮ ਇਹ ਸਾਫ ਸਫਾਈ ਦਾ ਕੰਮ ਅਤੇ ਨਾਲ ਹੋਰ ਵੀ ਬੜੇ ਕੰਮ ਹਨ ਮੋਚੀ ਆਪ ਰੋਜ਼ ਸਵੇਰੇ ਨੌ ਵਜੇ ਆ ਕੇ ਪੰਜ ਵਜੇ ਘਰ ਜਾਂਦਾ ਹਨ ਉਹ ਪੂਰੀ ਮਿਹਨਤ ਕਰਦਾ ਹੈ ਲੋਕਾਂ ਦੇ ਬੂਟ ਸਾਫ ਕਰਨ 'ਚ ਬੂਟ ਨੂੰ ਸੀਣਾ ਮਾਰਨ 'ਚ ਅਤੇ ਬੂਟ ਨੂੰ ਨਵੇਂ ਬਣਾਉਣ 'ਚ ਤਾਂ ਕਿ ਇਹ ਲੋਕਾਂ ਨੂੰ ਵੀ ਵਧੀਆ ਲੱਗੇ ਅਤੇ ਉਹਦੀ ਵੀ ਕਮਾਈ ਹੋ ਸਕੇ ਦਿਨ ਦੀ ਅਤੇ ਜਿੱਦਾਂ ਕਾਰਪੈਂਟਰ ਹਨ ਉਹ ਵੀ ਸਵੇਰੇ ਨੌ ਵਜੇ ਆਉਂਦਾ ਅਤੇ ਅਤੇ ਦਸ ਵਜੇ ਤੱਕ ਕਰ ਦਿੰਦਾ ਇਹ ਕੰਮ ਅਤੇ ਦਿਹਾੜੀ ਹਜ਼ਾਰ ਰੁਪਏ ਲਗਭਗ ਲੈਂਦਾ ਹੈ ਉਹ ਪੂਰੀ ਮਿਹਨਤ ਨਾਲ ਲੋਕਾਂ ਦੀਆਂ ਬਾਰੀਆਂ ਬਣਾਉਂਦਾ ਬੈੱਡ ਬਣਾਉਂਦਾ ਹੈ ਸੋਫੇ ਬਣਾ ਦਿੰਦਾ ਹੈ ਅਤੇ ਹੋਰ ਇਹ ਰਸੋਈ ਵਿੱਚ ਫਿਟਿੰਗ ਵੀ ਕਰ ਦਿੰਦਾ ਹੈ ਹੋਰ ਵੀ ਬੜੀ ਚੀਜ਼ਾਂ ਕਰਦਾ ਹੈ ਉਹ ਅਤੇ ਉਹ ਜਿੰਨੀ ਮਿਹਨਤ ਉਹ ਕਰਦਾ ਹੈ ਉਨੇ ਅੱਜ ਕੱਲ੍ਹ ਵੱਡੇ ਬਿਜਨਸਮੈਨ ਵੀ ਨਹੀਂ ਕਰਦੇ ਉਹ ਸਗੋਂ ਇੰਨੀ ਮਿਹਨਤ ਕਰਕੇ ਦਿਨ ਦੀ ਹਜ਼ਾਰ ਰੁਪਈਆ ਕਮਾਈ ਕਰਕੇ ਆਪਣੇ ਮਹੀਨੇ ਦੀ ਦਿਨ ਦਾ ਖਰਚਾ ਵੀ ਕੱਢਦਾ ਹੈ ਅਤੇ ਉਸ ਨਾਲ ਉਹਦੀ ਕਮਾਈ ਤਾਂ ਹੁੰਦੀ ਹੁੰਦੀ ਹੈ ਪਰ ਉਹ ਜਿੱਥੋਂ ਸਮਾਨ ਖਰੀਦ ਕੇ ਲਿਆਉਂਦਾ ਹੈ ਉਹ ਦੁਕਾਨ ਵਾਲੇ ਦੀ ਵੀ ਕਮਾਈ ਹੁੰਦੀ ਹੈ ਜਿਹਨਾਂ ਦੇ ਆਪ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਪੂਰੇ ਸਟੇਟ ਦੀ ਕਮਾਈ ਹੁੰਦੀ ਹੈ ਅਤੇ ਪੂਰੇ ਸਟੇਟ ਦੀ ਤਰੱਕੀ ਹੁੰਦੀ ਹੈ ਅੱਧੇ ਲੋਕ ਇੱਦਾਂ ਵੀ ਹਨ ਇੱਦਾਂ ਦੇ ਵੀ ਹਨ ਜਿਹੜੇ ਲੋਕਾਂ ਦੇ ਦੂਜੇ ਲੋਕਾਂ ਦੇ ਘਰ ਜਾ ਕੇ ਸਾਫ ਸਫਾਈ ਦਾ ਕੰਮ ਕਰਦੇ ਹਨ ਅਤੇ ਉਤੋਂ ਪੈਸੇ ਲੈਂਦੇ ਹਨ ਆਹ ਜ਼ਿਆਦਾਤਰ ਲੋਕ ਪੰਜ ਸੌ ਜਾਂ ਛੇ ਸੌ ਰੁਪਈਆ ਦਿਹਾੜੀ ਲੈਂਦੇ ਹਨ ਅਤੇ ਲੋਕ ਆਹ ਕੰਮ ਕਰਕੇ ਖੁਸ਼ ਵੀ ਹੁੰਦੇ ਹਨ ਅਤੇ ਨਾਲ ਪੈਸਾ ਕਮਾਉਣ ਦਾ ਸੌਖਾ ਸਾਧਨ ਹਨ ਨਾਲ ਜਿਸ ਨਾਲ ਉਹ ਆਪਣੇ ਦਿਨ ਦੀ ਦਿਹਾੜੀ ਵੀ ਕਰਦੇ ਹਨ ਅਤੇ ਨਾਲ ਲੋਕ ਖੁਸ਼ ਰਹਿੰਦੇ ਹਨ ਅਤੇ ਇੱਦਾਂ ਦੇ ਹੋਰ ਵੀ ਬੜੇ ਜ਼ਿਆਦਾ ਛੋਟੇ ਛੋਟੇ ਕਾਰੋਬਾਰ ਨੇ ਜਿਹੜੇ ਜਿਹੜੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਵੀ ਵਾਹਵਾ ਜ਼ਰੂਰੀ ਹਨ ਅਤੇ ਨਾਲੇ ਲੋਕਾਂ ਦੀ ਮਦਦ ਕਰਨ ਵਿੱਚ ਵੀ ਬੜਾ ਸਾਥ ਦਿੰਦੇ ਹਨ